ਦੋ ਲੱਖ ਸੱਤਰ ਹਜ਼ਾਰ ਪੰਜ ਸੋ ਪੰਤਾਲੀ ਇਕ ਲੱਖ ਪੰਜਾਹ ਹਜ਼ਾਰ ਪੰਝੱਤਰ ਹਜ਼ਾਰ ਇਕ ਲੱਖ ਵੀਹ ਹਜ਼ਾਰ ਇਕ ਲੱਖ ਗਿਆਰਾਂ ਹਜ਼ਾਰ